ਟੈਕਨੋਲਜੀ ਅਤੇ ਇੰਟਰਨੈੱਟ ਦੇ ਵੱਧਣ ਨਾਲ ਪੰਜਾਬੀ ਭਾਸ਼ਾ ਦੀ ਵਰਤੋਂ ਵਿੱਚ ਵਾਧਾ ਹੋਇਆ ਹੈ ਸਾਰੇ ਹੀ ਪੰਜਾਬੀ ਇੰਟਰਨੈੱਟ ਤੋਂ ਸਿੱਖ ਸਕਦੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪੜ੍ਹ ਸਕਦੇ ਹਨ ਇਤਿਹਾਸ ਦੀ ਸਾਖੀਆਂ ਬਾਰੇ ਜਾਣੂ ਹੁੰਦੇ ਹਨ ਪੰਜਾਬੀ ਭਾਸ਼ਾ ਬੋਲਣੀ ਵੀ ਸਿੱਖ ਸਕਦੇ ਹਨ ਅਸੀਂ ਸਾਰੇ ਇੱਕਮਿੱਕ ਹੋ ਜਾਂਦੇ ਹਾਂ ਪੰਜਾ ਟੈਕਨੋਲਜੀ ਅਤੇ ਇੰਟਰਨੈੱਟ ਦੇ ਵੱਧਣ ਨਾਲ ਪੰਜਾਬੀ ਭਾਸ਼ਾ ਵਿੱਚ ਕੋਈ ਬਦਲਾਅ ਨਹੀਂ ਆਇਆ